ਸਿਲਾਈ ਵਿੱਚ ਮੇਰੀ ਸਭ ਤੋਂ ਵੱਡੀ ਇਹ ਹੀ ਸਫ਼ਲਤਾ ਹੈ ਕਿ ਮੈਨੂੰ ਸਿਲਾਈ 'ਚ ਬਹੁਤ ਰੁਚੀ ਸੀਗੀ ਬਹੁਤ ਸ਼ੌਂਕ ਸੀਗਾ ਸਿਲਾਈ ਕਢਾਈ ਕਰਨ ਦਾ ਪਰ ਮੈਨੂੰ ਆਉਂਦੀ ਨਹੀਂ ਸੀ ਮੈਂ ਕੋਲਜ਼ ਟਾਈਮ ਤੋਂ ਹੀ ਮੈਨੂੰ ਬਹੁਤ ਸ਼ੌਂਕ ਸੀਗਾ ਜਦੋਂ ਮੈਂ ਗਿਆਰ੍ਹਵੀਂ ਬਾਰ੍ਹਵੀਂ ਕਰਦੀ ਸੀ ਤਾਂ ਮੇਰਾ ਮਨ ਪੂਰਾ ਸੀਗਾ ਕਿ ਮੈਂ ਪੂਰੇ ਸਿਲਾਈ 'ਚ ਆਪਣਾ ਕਰਾਂ ਔਰ ਮੈਂ ਬਿਲਕੁਲ ਇਹਦੇ 'ਚ ਹੀ ਪ੍ਰਫੈਸ਼ਨਲ ਹੋ ਜਾਵਾਂ ਪਰ ਮੈਨੂੰ ਨਹੀਂ ਆਈ ਮੇਰੀ ਇੱਕ ਫਰੈਂਡ ਸੀਗੀ ਉਹ ਕਰਦੀ ਹੈ ਉਹ ਮਤਲਬ ਬੁਟੀਕ ਦਾ ਕੰਮ ਕਰਦੀ ਹੈ ਜਿਹੜੀ ਬਹੁਤ ਹੀ ਅੱਛੇ ਉਹ ਕੱਪੜੇ ਸਿਉਂਦੀ ਉਹ ਸਭ ਦੇ ਤਾਂ ਉਹਨੂੰ ਦੇਖ ਕੇ ਮੈਨੂੰ ਬਹੁਤ ਜ਼ਿਆਦਾ ਮਨ 'ਚ ਆਇਆ ਕਿ ਜੇ ਇਹ ਕਰਦੀ ਤਾਂ ਮੈਂ ਕਿਉਂ ਨਹੀਂ ਕਰ ਸਕਦੀ ਮੈਂ ਵੀ ਇਹਦੇ ਵਿੱਚ ਅੱਗੇ ਜਾ ਸਕਦੀ ਹਾਂ ਬਹੁਤ ਪ੍ਰੋਫੈਸ਼ਨਲ ਵੇ ਨਾਲ ਜਾ ਸਕਦੀ ਆ ਕਰ ਸਕਦੀ ਹਾਂ ਤਾਂ ਮੇਰਾ ਸਭ ਤੋਂ ਵੱਡਾ ਇਹ 'ਚ ਇੱਕ ਇਹ ਵੀ ਅਨ ਅਨੁਭਵ ਸੀਗਾ ਕਿ ਮੈਨੂੰ ਜਿਹੜੀ ਕਰੋਸ਼ੀਆ ਸੀ ਉਹ ਬਿਲਕੁਲ ਨਹੀਂ ਆਉਂਦਾ ਸੀਗਾ ਤਾਂ ਮੇਰੀ ਫਰੈਂਡ ਨੇ ਸਿਲਾਈ ਦੇ ਨਾਲ ਨਾਲ ਮੈਨੂੰ ਕਰੋਸ਼ੀਆ ਵੀ ਸਿਖਾਇਆ ਤਾਂ ਮੈਂ ਆਪਣੇ ਆਪ ਇੱਕ ਪੌਂਚੂ ਬਣਾਇਆ ਇੱਕ ਆਪਣੇ ਪਾਉਣ ਵਾਲਾ ਤਾਂ ਜਿਹਨੂੰ ਦੇਖ ਕੇ ਸਾਰੇ ਬਹੁਤ ਖੁਸ਼ ਹੋਏ ਤਾਂ ਔਰ ਮੈਨੂੰ ਪੁੱਛਿਆ ਸਭ ਨੇ ਕਿ ਤੁਸੀਂ ਆਪ ਬਣਾਇਆ ਹੈ ਤਾਂ ਮੈਂ ਜਦੋਂ ਸਭ ਨੂੰ ਦੱਸਿਆ ਕਿ ਹਾਂਜੀ ਤਾਂ ਮੇਰੇ ਘਰ ਦੇ ਵੀ ਬਹੁਤ ਹੈਰਾਨ ਹੋਏ ਕਿ ਤੈਨੂੰ ਤਾਂ ਕਰੋਸ਼ੀਆ ਫੜਨਾ ਨਹੀਂ ਆਉਂਦਾ ਸੀਗਾ ਤੂੰ ਕਿੱਦਾਂ ਬਣਾ ਲਿਆ ਇਹ ਤਾਂ ਤੂੰ ਬਹੁਤ ਹੀ ਸੋਹਣਾ ਬਣਾਇਆ ਹੈ ਤਾਂ ਉਹ ਮੇਰਾ ਜ਼ਿੰਦਗੀ ਦਾ ਬਹੁਤ ਹੀ ਅੱਛਾ ਅਨੁਭਵ ਸੀਗਾ ਕਿ ਮਤਲਬ ਜ਼ਿੰਦਗੀ 'ਚ ਕੁਛ ਵੀ ਔਖਾ ਨਹੀ ਹੈਗਾ ਅਗਰ ਤੁਸੀਂ ਕਰਨ ਤੋਂ ਆ ਜੋ ਤਾਂ ਤੁਸੀਂ ਸਭ ਕੁਛ ਕਰ ਸਕਦੇ ਹਾਂ ਜੇ ਤੁਸੀਂ ਆਪਣਾ ਮਨ ਬਣਾ ਲਵੋ ਤਾਂ ਕੁਛ ਵੀ ਔਖਾ ਨਹੀ ਹੈਗਾ ਹੁਣ ਮੈਂ ਹੁਣ ਪੂਰਾ ਆਪਣਾ ਜ਼ੋਰ ਹੁਣ ਸਿਲਾਈ 'ਤੇ ਲੋ ਰਹੀ ਲਾ ਰੀ ਹਾਂ ਕਿਉਂਕਿ ਮੈਂ ਸਿਲਾਈ ਨੂੰ ਮੈਨੂੰ ਬਹੁਤ ਹੀ ਦਿਲ ਸੀਗਾ ਸ਼ ਮਤਲਬ ਆਪਣੀ ਪੜ੍ਹਾਈ ਟਾਈਮ ਤੋਂ ਸਕੂਲ ਕੋਲੇਜ ਟਾਈਮ ਤੋਂ ਤਾਂ ਹੁਣ ਮੈਂ ਬਿਲਕੁਲ ਸੋਚਦੀ ਹਾਂ ਕਿ ਮੈਂ ਉਹਦੇ 'ਚ ਆਪਣਾ ਪ੍ਰੋਫੈਸ਼ਨ ਮਤਲਬ ਹੂੰਕ ਕਰਨਾ ਆ ਪ੍ਰੋਫੈਸ਼ਨਲ ਬਣਨਾ ਹਾਂ ਅਤੇ ਮੈਂ ਹਜੇ ਤੱਕ ਤਾਂ ਕਿਸੇ ਮੁਕਾਬਲੇ 'ਚ ਨਹੀਂ ਗਈ ਜੇ ਮੈਨੂੰ ਅੱਗੋਂ ਕਿਤੇ ਵੀ ਇਸ ਚੀਜ਼ 'ਤੇ ਮੌਕਾ ਮਿਲੇਗਾ ਜਦੋ ਮੈਂ ਆਪਣਾ ਸਿੱਖ ਲਵਾਂਗੀ ਪੂਰੀ ਤਰ੍ਹਾਂ ਸਿਲਾਈ ਕਢਾਈ ਮੈਨੂੰ ਇਸ 'ਚ ਅਗਰ ਮੌਕਾ ਮਿਲਿਆ ਤਾਂ ਮੈਂ ਜ਼ਰੂਰ ਜਾਵਾਂਗੀ ਕਿਉਂਕਿ ਇਹ ਤਾਂ ਮੈਨੂੰ ਆਪਣੇ ਸਕੂਲ ਕੋਲਜ਼ ਟਾਈਮ ਤੋਂ ਹੀ ਇਹਦੇ 'ਚ ਮੇਰਾ ਸੀ ਗੀ ਰੁਚੀ ਕਿ ਮੈਂ ਸਿਲਾਈ ਕਢਾਈ ਕਰਾਂ ਔਰ ਇਹਦੇ 'ਚ ਮੈਂ ਆਪਣਾ ਬਹੁਤ ਅੱਗੇ ਤੱਕ ਜਾਵਾਂ ਇਹ ਮੇਰੇ ਬਹੁਤ ਹੀ ਮੇਰਾ ਮਤਲਬ ਮੇਰੀ ਹੌਬੀ ਸੀਗੀ